ਮੈਂ ਕਈ ਤੱਤਾਂ ਅਤੇ ਵਿਸ਼ਿਆ ਨਾਲ ਇੱਕ ਵੱਡੇ ਪੈਮਾਨੇ ਦੀ ਡਰਾਇੰਗ ਦੀ ਰਚਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਸੋਚਿਆ ਹੈ ਕਿ ਮੈਂ ਇੱਕ ਪੇਂਡੂ ਮੇਲੇ ਦੇ ਉੱਪਰ ਇੱਕ ਵੱਡੇ ਪੈਮਾਨੇ ਦੀ ਡਰਾਇੰਗ ਬਣਾ ਬਣਾਵਾਂਗਾ ਜਿਸ ਵਿੱਚ ਕਈ ਤੱਤ ਹੋਣਗੇ ਅਤੇ ਕਈ ਵਿਸ਼ੇ ਜਿਹਦੇ ਵਿੱਚ ਕਵਰ ਹੋਣਗੇ ਇਸ ਡਰਾਇੰਗ ਦੇ ਨਾਲ ਮੈਂ ਪੇਂਡੂ ਸੱਭਿਆਚਾਰ ਪੰਜਾਬੀ ਲੋਕਾਂ ਦਾ ਪਹਿਰਾਵਾ ਪੰਜਾਬੀ ਲੋਕਾਂ ਦੇ ਇੰਟਰਸਟ ਉਹਨਾਂ ਦੇ ਰੁਚੀਆਂ ਉਹਨਾਂ ਦੇ ਮਨ ਪਰਚਾਵੇ ਉਹਨਾਂ ਦੇ ਮਨੋਰੰਜਨ ਉਹਨਾਂ ਦੀਆਂ ਖੇਡਾਂ ਇਹਨਾਂ ਚੀਜ਼ਾਂ ਨੂੰ ਉਹਨਾਂ ਦੇ ਪਸੰਦ ਦੀਆਂ ਫਲ ਫਰੂਟ ਉਹਨਾਂ ਦੇ ਪਸੰਦ ਦੀਆਂ ਮਿਠਿਆਈਆਂ ਇਹ ਸਾਰੇ ਵਿਸ਼ਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਇੱਕੋ ਹੀ ਡਰਾਇੰਗ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਕਵਰ ਹੋ ਜਾਣ ਜਿਸ ਵਿੱਚ ਕਈ ਤੱਤ ਸ਼ਾਮਿਲ ਹੋ ਜਾਣਗੇ ਕਈ ਵਿਸ਼ੇ ਇਕੱਠੇ ਹੀ ਕਵਰ ਹੋ ਜਾਣਗੇ ਇਸ ਵਿੱਚ ਉਹਨਾਂ ਦੇ ਝੂਲੇ ਉਹਨਾਂ ਦੇ ਪਹਿਰਾਵੇ ਅਤੇ ਉਹ ਕੀ ਮਿਠਾਈਆਂ ਖਾਂਦੇ ਨੇ ਕਿਸ ਤਰ੍ਹਾਂ ਉਸ ਸਜ ਕੇ ਜਾਂਦੇ ਨੇ ਕੀ ਸਾਧਨਾਂ 'ਤੇ ਉਹ ਜਾਂਦੇ ਨੇ ਕਿਸ ਤਰ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਨੇ ਇਹ ਸਾਰਾ ਕੁਛ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਇਸ ਯੋਜਨਾ ਮੰਦੀ ਨੇ ਜੀ ਖਾਕਾ ਪ੍ਰਕਿਰਿਆ 'ਚੋਂ ਲੰਘਣਾ ਮੈਨੂੰ ਠੀਕ ਲੱਗਦਾ ਹੈ ਆਰਾਮ ਨਾਲ ਮੇਰੇ ਖਿਆਲ 'ਚ ਇਹ ਕੰਮ ਹੋ ਜਾਵੇਗਾ ਕਿਉਂਕਿ ਇਸ ਕੰਮ ਲਈ ਸਭ ਤੋਂ ਪਹਿਲਾਂ ਮੈਂ ਇੱਕ ਪੇਂਡੂ ਮੇਲੇ ਵਿੱਚ ਜਾਊਂਗਾ ਉਹ ਮੇਲੇ ਨੂੰ ਵਾਚੂੰਗਾ ਦੂਰ ਬਹਿ ਕੇ ਦੇਖੂੰਗਾ ਵੀ ਲੋਕ ਕਿਸ ਤਰ੍ਹਾਂ ਆਉਂਦੇ ਨੇ ਕਿਹੋ ਜਿਹਾ ਪਹਿਰਾਵਾ ਪਹਿਨ ਕੇ ਆਉਂਦੇ ਨੇ ਕਿਹੋ ਜਿਹੇ ਸਾਧਨਾਂ 'ਤੇ ਪਹੁੰਚਦੇ ਨੇ ਕੀ ਕੁਛ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਕਿਸ ਤਰ੍ਹਾਂ ਦੀਆਂ ਉਹ ਬੋਲੀਆਂ ਜਾਂ ਡਾਂਸ ਪਾਉਂਦੇ ਨੇ ਡਾਂਸ ਕਰਦੇ ਨੇ ਅਤੇ ਕਿਸ ਤਰ੍ਹਾਂ ਉਹ ਬੱਚਿਆਂ ਨੂੰ ਮਨੋਰੰਜਨ ਕਰਵਾਉਂਦੇ ਨੇ ਇਹ ਸਾਰਾ ਕੁਛ ਦੇਖਿਆ ਜਾਵੇਗਾ ਕਿਸ ਤਰ੍ਹਾਂ ਦਾ ਲੰਗਰ ਕਿਸ ਤਰ੍ਹਾਂ ਬਹਿ ਕੇ ਛਕਦੇ ਨੇ ਜਾਂ ਖੜ ਕੇ ਖਾਂਦੇ ਨੇ ਉਹਨਾਂ ਦਾ ਉੱਠਣ ਬੈਠਣ ਕੀ ਹੈ ਉਹਨਾਂ ਦਾ ਹੱਸਣ ਖੇਡਣ ਕੀ ਹੈ ਇਹ ਸਾਰਾ ਕੁਛ ਮੈਂ ਦੂਰੋਂ ਵਾਚ ਕਰੂੰਗਾ ਉਸ ਤੋਂ ਬਾਅਦ ਇਸ ਵਿੱਚ ਕਿਉਂਕਿ ਕਈ ਵਿਸ਼ੇ ਕਵਰ ਹੋ ਜਾਂਦੇ ਨੇ ਪੰਜਾਬੀ ਸੱਭਿਆਚਾਰ ਕਵਰ ਹੋ ਗਿਆ ਪੰਜਾਬੀਆਂ ਦਾ ਪਹਿਰਾਵਾ ਕਵਰ ਹੋ ਗਿਆ ਪੰਜਾਬੀਆਂ ਦਾ ਖਾਣ ਪੀਣ ਕਵਰ ਹੋ ਗਿਆ ਅਤੇ ਸਾਰੇ ਵਿਸ਼ਿਆਂ ਨੂੰ ਲੈ ਕੇ ਮੈਂ ਇੱਕ ਵੱਡੇ ਪੈਮਾਨੇ ਦੀ ਡਰੈਂਗ ਬਣਾਉਣ ਦੀ ਕੋਸ਼ਿਸ਼ ਕਰੂੰਗਾ ਅਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅੱਛੀ ਅਤੇ ਵਧੀਆ ਡਰਾਇੰਗ ਬਣ ਜਾਵੇਗੀ ਅਤੇ ਜਿਸ ਨਾਲ ਮੈਂ ਸਾਰੇ ਵਿਸ਼ਿਆਂ ਨੂੰ ਅਤੇ ਸਾਰੇ ਤੱਤਾਂ ਨੂੰ ਛੂਹ ਲੂੰਗਾ ਇਹ ਡਰਾਇੰਗ ਬਣਾਉਣ ਦੀ ਮੈਂ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਅਤੇ ਮੈਂ ਇਸ ਵਿੱਚ ਸਫਲ ਵੀ ਬਿਲਕੁਲ ਹੋਵਾਂਗਾ